ਹਾਂਜੀ ਸਤਿ ਸ਼੍ਰੀ ਅਕਾਲ ਪਿੰਡ ਵਿੱਚ ਬਿਜਲੀ ਤੋਂ ਬਿਨਾਂ ਕੋਈ ਵੀ ਕੰਮ ਕਰਨਾ ਸੰਭਵ ਨਹੀਂ ਹੈ ਬਲਕਿ ਬਿਜਲੀ ਨਾਲ ਪਿੰਡ ਵਿੱਚ ਰੌਸ਼ਨੀ ਨਹੀਂ ਹੁੰਦੀ ਜੇ ਪਿੰਡ ਵਿੱਚ ਬਿਜਲੀ ਹੋਵੇਗੀ ਤਾਂ ਪਿੰਡ ਰੋਸ਼ਨ ਰਹੇਗਾ ਸਾਡੇ ਪਿੰਡ ਵਿੱਚ ਆਮ ਕਰਕੇ ਬਿਜਲੀ ਤੋਂ ਬਿਨਾਂ ਕੰਮ ਨਹੀਂ ਕੀਤੇ ਜਾਂਦੇ ਪਿੰਡ ਵਿੱਚ ਬਿਜਲੀ ਤੋਂ ਬਿਨਾਂ ਪੜ੍ਹਾਈ ਕਰਨਾ ਅਸੰਭਵ ਹੈ ਬਿਜਲੀ ਦੇ ਹੋਣ ਨਾਲ ਅਸੀਂ ਬਹੁਤ ਸਾਰੇ ਕੰਮ ਕਰ ਸਕਦੇ ਹਾਂ ਜਿਵੇਂ ਕਿ ਸਿਲਾਈ ਕਢਾਈ ਦਾ ਕੰਮ ਕੀਤਾ ਜਾਂਦਾ ਹੈ ਕੱਪੜੇ ਪ੍ਰੈਸ ਬਿਜਲੀ ਤੋਂ ਬਿਨਾਂ ਨਹੀਂ ਹੁੰਦੇ ਰਸੋਈ ਦੇ ਬਹੁਤ ਸਾਰੇ ਕੰਮ ਬਿਜਲੀ ਨਾਲ ਕੀਤੇ ਜਾਂਦੇ ਹਨ ਜਿਵੇਂ ਕਿ ਜੂਸ ਕੱਢਣ ਲਈ ਜੂਸਰ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਵੀ ਬਿਜਲੀ ਤੋਂ ਚੱਲਦਾ ਹੈ ਖੇਤ ਖੇਤਾਂ ਵਿੱਚ ਮਸ਼ੀਨਾਂ ਰਾਹੀਂ ਫ਼ਸਲਾਂ ਬੀਜੀਆਂ ਜਾ ਰਹੀਆਂ ਹਨ ਜੋ ਕਿ ਬਿਜਲੀ 'ਤੇ ਚਲਦੀਆਂ ਹਨ ਆਮ ਤੌਰ 'ਤੇ ਅੱਜ ਦੇ ਸਮੇਂ ਵਿੱਚ ਬਿਜਲੀ ਤੋਂ ਬਿਨਾਂ ਕੋਈ ਵੀ ਕੰਮ ਕਰਨਾ ਅਸੰਭਵ ਹੈ ਖੇਤਾਂ ਵਿੱਚ ਆਮ ਕਰਕੇ ਬਿਜਲੀ ਤੋਂ ਬਿਨਾਂ ਪਾਣੀ ਨਹੀਂ ਆਉਂਦਾ ਜੋ ਕਿ ਅਸੀਂ ਫ਼ਸਲ ਪਾਣੀ ਤੋਂ ਬਿਨਾਂ ਨਹੀਂ ਉਗਾ ਸਕਦੇ